ਸਤਿ ਸ਼੍ਰੀ ਅਕਾਲ ਮੈਂ ਕਮਲਪ੍ਰੀਤ ਗੱਲ ਕਰ ਰਹੀ ਹਾਂ ਮੈਂ ਕੁਛ ਦਿਨ ਪਹਿਲਾਂ ਤੁਹਾਡੇ ਇੰਸਟਾਗ੍ਰਾਮ ਪੇਜ ਤੋਂ ਇੱਕ ਸਮਾਰਟ ਵੋਚ ਔਡਰ ਕੀਤੀ ਸੀ ਜੋ ਕਿ ਯੂ ਆਈ ਦੀ ਸਮਾਰਟ ਵੋਚ ਸੀ ਮੈਂ ਇਸ ਦੇ ਬਾਰੇ ਤੁਹਾਨੂੰ ਕੁਝ ਦੱਸਣਾ ਚਾਹੂੰਗੀ ਜਿਵੇਂ ਕਿ ਡਿਲੀਵਰੀ ਤੁਸੀਂ ਪੰਦਰਾਂ ਦਿਨ ਦਾ ਟਾਈਮ ਕਿਹਾ ਸੀ ਪਰ ਉਹ ਪਹਿਲੇ ਹਫਤੇ ਵਿੱਚ ਹੀ ਮੇਰੇ ਤੱਕ ਪਹੁੰਚ ਗਈ ਜੋ ਕਿ ਮੈਨੂੰ ਜਿਸਦੇ ਨਾਲ਼ ਮੈਂ ਬਹੁਤ ਖੁਸ਼ ਸੀ ਅਤੇ ਉਸਦੀ ਪੈਕਿੰਗ ਵੀ ਬਹੁਤ ਵਧੀਆ ਸੀਗੀ ਮੈਂ ਕਲਰ ਰੋਇਲ ਬਲੈਕ ਮੰਗਿਆ ਸੀ ਤਾਂ ਤੁਸੀਂ ਬਿਲਕੁਲ ਐਗਜੈਕਟ ਰੋਇਲ ਬਲੈਕ ਕਲਰ ਹੀ ਭੇਜਿਆ ਅਤੇ ਇਹਦੀ ਡਿਸਪਲੇਅ ਵੀ ਬਹੁਤ ਸਮੂਦ ਹੈ ਕੰਮ ਵੀ ਬਹੁਤ ਫਾਸਟ ਕਰਦੀ ਹੈ ਅਤੇ ਇਸਦੇ ਹੋਰ ਵੀ ਬਹੁਤ ਸਾਰੇ ਫੀਚਰਸ ਹੈ ਇਸ ਇਸਦੇ ਵਿੱਚ ਜਿਵੇਂ ਕਿ ਮੈਨੂੰ ਇਹ ਟਾਈਮ ਟੂ ਟਾਈਮ ਪਾਣੀ ਪੀਣ ਲਈ ਅਲਾਰਮ ਕਰ ਅਲਾਰਮ ਦਿੰਦਾ ਅਤੇ ਸੈਰ ਸੈਰ ਲਈ ਕਰਨ ਲਈ ਵੀ ਸਵੇਰੇ ਸਵੇਰੇ ਮੈਨੂੰ ਅਲਾਰਮ ਮਿਲਦਾ ਅਤੇ ਫਿਰ ਮਤਲਬ ਟਾਈਮ ਟੂ ਟਾਈਮ ਮੈਂ ਸਭ ਕੁਛ ਕਰ ਪਾ ਰਹੀ ਹਾਂ ਫਿਰ ਇਸਦੇ ਹੋਰ ਐਪਲੀਕੇਸ਼ਨਸ ਹਨ ਜਿਸ ਦੇ ਨਾਲ਼ ਮੈਨੂੰ ਮੇਰੀ ਹੈਲਥ ਨਾਲ ਰਿਲੇਟਡ ਵੀ ਬਹੁਤ ਕੁਛ ਪਤਾ ਚੱਲਦਾ ਜਿਵੇਂ ਕਿ ਬਲੱਡ ਪ੍ਰੈਸ਼ਰ ਹੋ ਗਿਆ ਬੀ ਪੀ ਸ਼ੂਗਰ ਹੈਲ ਹਾਰਟਬੀਟ ਇਹ ਸਭ ਕੁਛ ਵੀ ਮੈਨੂੰ ਪਤਾ ਚਲਦਾ ਹੈ ਇਹ ਬਹੁਤ ਹੀ ਲਾਈਟ ਵੇਟ ਹੈ ਜਿਸ ਨਾਲ ਕਿ ਮੈਨੂੰ ਮੇਰੇ ਹੱਥ 'ਤੇ ਕੋਈ ਭਾਰ ਵੀ ਮਹਿਸੂਸ ਨਹੀਂ ਹੁੰਦਾ ਪਤਾ ਵੀ ਨਹੀਂ ਲੱਗਦਾ ਅਤੇ ਫਿਰ ਇਸ ਦੇ ਨਾਲ ਮੈਨੂੰ ਇੱਕ ਫਰੀ ਗਿਫਟ ਵੀ ਮਿਲਿਆ ਆ ਹੈਡਫੋਨਸ ਜਿਹਦੇ ਨਾਲ ਮੈਂ ਬਹੁਤ ਜਿਆਦਾ ਖੁਸ਼ ਹਾਂ ਇਹ ਸਮਾਟ ਵੋਚ ਮੇਰੇ ਫਰੈਂਡਸ ਨੂੰ ਵੀ ਬਹੁਤ ਪਸੰਦ ਆਈ ਆ ਉਹਨਾਂ ਨੇ ਵੀ ਇਹ ਸ ਉਹਨਾਂ ਨੂੰ ਮੈਂ ਸੁਜੈਸਟ ਵੀ ਕੀਤਾ ਕਿ ਉਹ ਇੰਸਟਾ ਤੁਹਾਡੇ ਇੰਸਟਾਗ੍ਰਾਮ ਪੇਜ ਤੋਂ ਇਹ ਖਰੀਦੇ ਅਤੇ ਉਹ ਵੀ ਤੁਹਾਡੇ ਤੋਂ ਹੀ ਇੰਸ ਖਰੀਦਣਾ ਚਾਹੁੰਦੇ ਆ